ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਮੋਹਾਲੀ ਜ਼ਿਲ੍ਹਾ ਬਹੁਤ ਇੱਕ ਵੱਡਾ ਜ਼ਿਲ੍ਹਾ ਹੈ ਅਤੇ ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਹਰ ਦੋ ਕਿਲੋਮੀਟਰ ਤੋਂ ਬਾਅਦ ਭਾਸ਼ਾ ਚੇਂਜ ਹੁੰਦੀ ਹੈ ਅਤੇ ਮੋਹਾਲੀ ਦੇ ਪੇਂਡੂ ਇਲਾਕਿਆਂ ਵਿੱਚ ਆਮ ਤੌਰ 'ਤੇ ਪੁਆਧੀ ਭਾਸ਼ਾ ਜ਼ਿਆਦਾ ਵਰਤੋਂ ਵਿੱਚ ਲਿਆਈ ਜਾਂਦੀ ਹੈ ਅਤੇ ਜਿਵੇਂ ਹੀ ਆਪਾਂ ਮੋਹਾਲੀ ਦੇ ਸ਼ਹਿਰੀ ਇਲਾਕੇ ਵੱਲ ਵੱਧਦੇ ਹਾਂ ਅਤੇ ਉੱਥੇ ਪਿਓਰ ਪੰਜਾਬੀ ਦੀ ਵਰਤੋਂ ਜ਼ਿਆਦਾ ਹੁੰਦੀ ਹੈ ਅਤੇ ਜਿਵੇਂ ਤੁਹਾਨੂੰ ਪਤਾ ਹੈ ਕਿ ਮੋਹਾਲੀ ਜ਼ਿਲ੍ਹਾ ਇੱਕ ਉਦਯੋਗੀਕਰਨ ਜ਼ਿਲ੍ਹਾ ਹੈ ਜਿੱਥੇ ਕਿ ਬਹੁਤ ਵੱਡੀਆਂ ਵੱਡੀਆਂ ਫੈਕਟਰੀਆਂ ਹੋਣ ਦੇ ਕਾਰਨ ਉੱਥੋਂ ਦੇ ਲਾਗੇ ਦੇ ਜ਼ਿਲ੍ਹਿਆਂ ਦੇ ਲੋਕ ਜਿਵੇਂ ਹਿਮਾਚਲ ਹਰਿਆਣਾ ਰਾਜਸਥਾਨ ਯੂ ਪੀ ਅਲੱਗ ਅਲੱਗ ਜਿਹੜੇ ਜ਼ਿਲ੍ਹਿਆਂ ਦੇ ਲੋਕ ਇੱਥੇ ਆ ਕੇ ਰਹਿੰਦੇ ਨੇ ਅਤੇ ਉਹਨਾਂ ਦੇ ਰਹਿਣ ਨਾਲ ਜਿਵੇਂ ਇੱਧਰ ਦੇ ਪੰਜਾਬ ਦੇ ਲੋਕ ਨੇ ਉਹਨਾਂ ਨਾਲ ਆਪਣਾ ਪੂਰਾ ਭਾਈਚਾਰਾ ਦਿਖਾਉਂਦੇ ਨੇ ਅਤੇ ਉਹ ਭਾਈਚਾਰੇ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਜਿਹੜੇ ਪੰਜਾਬ ਦੇ ਲੋਕ ਹੁੰਦੇ ਨੇ ਉਹ ਉਹਨਾਂ ਦੀ ਲੈਂਗੁਏਜ ਬੋਲਣ ਦੀ ਕੋਸ਼ਿਸ਼ ਕਰਦੇ ਨੇ ਅਤੇ ਇਵੇਂ ਹੀ ਹੋਰ ਸਟੇਟਾਂ ਦੇ ਲੋਕ ਇੱਧਰ ਪੰਜਾਬ ਆ ਕੇ ਉਹਨਾਂ ਦੀ ਖੁਦ ਹੀ ਪੰਜਾਬੀ ਲੈਂਗੁਏਜ ਸਿੱਖਣ ਦੀ ਕੋਸ਼ਿਸ਼ ਕਰਦੇ ਆਂ